ਮੇਰਾ ਖੇਤਰ ਬਠਿੰਡਾ ਇਸ ਵਿੱਚ ਬਹੁਤ ਸਾਰੇ ਕੁਦਰਤੀ ਸਰੋਤ ਮੌਜੂਦ ਹਨ ਜਿਹਨਾਂ ਦੀ ਵਰਤੋਂ ਕਰਕੇ ਅਸੀਂ ਵਪਾਰਕ ਵਿੱਚ ਖੇਤਰ ਵਿੱਚ ਵੀ ਵਰਤ ਸਕਦੇ ਹਾਂ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਬਠਿੰਡਾ ਏਰੀਆ ਖੁਸ਼ਕ ਅਤੇ ਗਰਮ ਏਰੀਆ ਹੈ ਇਸ ਲਈ ਇਸ ਗਰਮੀ ਦਾ ਫਾਇਦਾ ਉਠਾ ਕੇ ਇੱਥੇ ਸੋਲੋ ਪਲਾਂਟ ਲਗਾਏ ਜਾ ਸਕਦੇ ਹਨ ਸੋਲੋ ਪਲਾਂਟ ਦੀ ਵਰਤੋਂ ਕਰਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਇਹ ਇੱਕ ਬਿਲ ਕੁਦਰਤ ਦੁਆਰਾ ਦਿੱਤਾ ਗਿਆ ਮੁਫਤ ਦਾ ਸੋਰਸ ਹੈ ਇਸ ਤੋਂ ਅਸੀਂ ਬਿਜਲੀ ਪੈਦਾ ਕਰ ਸਕਦੇ ਹਾਂ ਬਿਜਲੀ ਦਾ ਬਹੁਤ ਸਾਰਾ ਫਾਇਦਾ ਹੁੰਦਾ ਹੈ ਇਹ ਐਨਰਜੀ ਨੂੰ ਬਚਾਉਂਦਾ ਹੈ ਅਤੇ ਇਕ ਵਾਤਾਵਰਨ ਨੂੰ ਵੀ ਕਿਸੇ ਪ੍ਰਕਾਰ ਦਾ ਕੋਈ ਵੀ ਨੁਕਸਾਨ ਨਹੀਂ ਪਹੁੰਚਾਉਂਦਾ ਇਸ ਲਈ ਅਸੀਂ ਸੂਰਜ ਦੀ ਗਰਮੀ ਤੋਂ ਸੋਲਰ ਪਲਾਂਟ ਲਗਾ ਕੇ ਬਿਜਲੀ ਪੈਦਾ ਕਰ ਸਕਦੇ ਹਾਂ